ਭਾਰਤ ਵਿੱਚ ਕਈ ਤਰ੍ਹਾਂ ਦੇ ਮਹੱਤਵਪੂਰਨ ਤਿਉਹਾਰ ਮਨਾਏ ਜਾਂਦੇ ਹਨ ਭਾਰਤ ਵਿੱਚ ਬਹੁਤ ਸਾਰੇ ਤਿਉਹਾਰ ਹਨ ਇਹ ਸਟਾਰਟਿੰਗ ਤੋਂ ਹੀ ਪਹਿਲੇ ਮ ਪਹਿਲੇ ਮਹੀਨੇ ਤੋਂ ਹੀ ਇਹ ਤਿਉਹਾਰ ਸ਼ੁਰੂ ਹੋ ਜਾਂਦੇ ਹਨ ਜਿਵੇਂ ਕਿ ਲੋਹੜੀ ਫਿਰ ਉਸ ਤੋਂ ਬਾਅਦ ਹੋਲੀ ਅਤੇ ਸਿੱਖਾਂ ਦਾ ਤਿਉਹਾਰ ਵਿਸਾਖੀ ਦਾ ਵੀ ਮਨਾਇਆ ਜਾਂਦਾ ਹੈ ਉਸ ਤੋਂ ਵਿੱਚ ਵਿਚਾਲੇ ਕਈ ਤਿਉਹਾਰ ਹਨ ਅਤੇ ਅੰਤ ਦੇ ਮਹੀਨੇ ਵਿੱਚ ਜਿਵੇਂ ਦੁਸਹਿਰੇ ਹੋ ਦੀਵਾਲੀ ਬਹੁਤ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਇੱਕ ਮਹੱਤਵਪੂਰਨ ਵੀ ਹੈ ਅਤੇ ਬਹੁਤ ਹੀ ਮਹੱਤਵਪੂਰਨ ਹੈ ਅਤੇ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਵੀ ਹੈ ਇਸ ਤੋਂ ਬਾਅਦ ਜਿਸ ਜਿਸ ਦਿਨ ਦੀ ਵੀ ਤਿਉਹਾਰ ਹੁੰਦੇ ਹਨ ਉਸ ਦਿਨ ਛੁੱਟੀਆਂ ਹੁੰਦੀਆਂ ਹੈ ਅਤੇ ਉਸ ਦਿਨ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਹੁੰਦਾ ਹੈ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਭਾਰਤ ਵਿੱਚ ਸ਼ਹਿਰ ਵਿੱਚ ਕਈ ਥਾਂ 'ਤੇ ਤਾਂ ਇਹ ਤਿਉਹਾਰ ਮਨਾਏ ਨਹੀਂ ਜਾਂਦੇ ਹਨ ਪਰ ਪਿੰਡਾਂ ਵਿੱਚ ਹੁਣ ਤੱਕ ਵੀ ਇਹ ਤਿਉਹਾਰਾਂ ਨੂੰ ਬਹੁਤ ਹੀ ਮਹੱਤਵਪੂਰਨ ਦਿੱਤਾ ਜਾਂਦਾ ਹੈ ਅਤੇ ਬਹੁਤ ਹੀ ਖੁਸ਼ੀਆਂ ਭਰਿਆ ਹੁੰਦਾ ਹੈ ਆਪਸ ਵਿੱਚ ਲੋਕ ਬਹੁਤ ਜ਼ਿਆਦਾ ਘੁਲ ਮਿਲ ਜਾਂਦੇ ਹਨ ਇਹ ਤਿਉਹਾਰਾਂ ਵਿੱਚ